ਪਿਛਲੇ ਸਮਿਆਂ ਵਿੱਚ ਖੂਹ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਸੀ ਅਤੇ ਖੂਹ ਨੂੰ ਪੁੱਟਣ ਲਈ ਪਹਿਲਾਂ ਪਹਿਲਾਂ ਲੋਕ ਹੱਥਾਂ ਨਾਲ ਖੂਹ ਪੱਟਦੇ ਸਨ ਅਤੇ ਹੁਣ ਖੂਹ ਨੂੰ ਮਸ਼ੀਨਾਂ ਰਾਹੀਂ ਇਲੈਕਟਰੋਨਿਕ ਮਸ਼ੀਨਾਂ ਰਾਹੀਂ ਪੱਟਿਆ ਜਾ ਸਕਦਾ ਹੈ ਅਤੇ ਖੂਹ ਪਰ ਲੱਗੀ ਹੋਈ ਪੁਲੀ ਅਤੇ ਮਜਬੂਤ ਰੱਸੀ ਅਤੇ ਬਾਲਟੀ ਨਾਲ ਕੱਢਿਆ ਜਾਂਦਾ ਸੀ ਪਿਛਲੇ ਸਮੇਂ ਵਿੱਚ ਕਈ ਔਰਤਾਂ ਪਾਣੀ ਨੂੰ ਕੱਢਣ ਨਾਲ ਬਾਲਟੀ ਵਿੱਚ ਛੁੱਟਣ ਦਾ ਰੱਸੀ ਨੂੰ ਉੱਪਰ ਖਿੱਚਦੀਆਂ ਅਤੇ ਪਾਣੀ ਕੱਢਦੀਆਂ ਉਸ ਪਾਣੀ ਦੀ ਵਰਤੋਂ ਬਹੁਤ ਕਰਦੀਆਂ ਬਹੁਤ ਕੀਤੀ ਜਾਂਦੀ ਸੀ ਅਤੇ ਉਸ ਦੇ ਨਾਲ ਕਈ ਔਰਤਾਂ ਕੱਪੜੇ ਧੋਂਦੀਆਂ ਜਾਂ ਔ ਹੋਰ ਵੀ ਕੰਮ ਕਰਦੀਆਂ ਸਨ ਇਸ ਸਮੇਂ ਵਿੱਚ ਖੂਹ ਦੀ ਵਰਤੋਂ ਘਟ ਰਹੀ ਹੈ ਅਤੇ ਜਿਵੇਂ ਕਿ ਸਮਾਂ ਬਦਲਦਾ ਜਾਂਦਾ ਹੈ ਅਤੇ ਇਸ ਲਈ ਖੂਹ ਦੀ ਵਰਤੋਂ ਘੱਟਦੀ ਜਾਂਦੀ ਹੈ ਖੂਹ ਦਾ ਪਾਣੀ ਬਹੁਤ ਹੀ ਡੂੰਘਾ ਜਾ ਚੁੱਕਿਆ ਹੈ ਜਿਵੇਂ ਕਿ ਸਾਨੂੰ ਪਾਣੀ ਕੱਢਣ ਵਿੱਚ ਬਹੁਤ ਹੀ ਜ਼ਿਆਦਾ ਸਮੱਸਿਆ ਆਉਂਦੀ ਹੈ ਬਹੁਤ ਹੀ ਜ਼ਿਆਦਾ ਸਮੱਸਿਆ ਆਉਂਦੀ ਹੈ ਅਤੇ ਖੂਹ ਨੂੰ ਅੱਜ ਕੱਲ੍ਹ ਇਲੈਕਟ੍ਰੋਨਿਕ ਮਸ਼ੀਨਾਂ ਰਾਹੀਂ ਉਸ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਅਤੇ ਮਸੀਨ ਨਾਲ ਮਸ਼ੀਨਾਂ ਰਾਹੀਂ ਉਸਨੂੰ ਪਾਣੀ ਕੱਢਿਆ ਜਾਂਦਾ ਹੈ ਅਤੇ ਸਵਿਚ ਔਨ ਕਰਨ ਜਾਂ ਬੰਦ ਕਰਨ ਨਾਲ ਪਾਣੀ ਹੀ ਕੱਢਿਆ ਜਾਂਦਾ ਹੈ